ਪੰਜਾਬ ਵਿੱਚ ਟੈਕਨੋਲੋਜੀ ਅਤੇ ਉਦਯੋਗ ਦੇ ਵਿਕਾਸ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਲੱਗਦੀਆਂ ਹਨ ਜੋ ਟੈਕਨੋਲੋਜੀ ਪੇਸ਼ੇਵਰਾਂ ਉੱਦਮੀਆਂ ਅਤੇ ਨਿਵੇਸ਼ਕਾਂ ਨੂੰ ਇਕੱਠੇ ਕਰਦੀਆਂ ਹਨ ਇੰਟਰਨੈਸ਼ਨਲ ਕਾਨਫਰੰਸ ਔਨ ਵਾਇਰਲੈਸ ਕਮਿਊਨੀਕੇਸ਼ਨ ਐਨ ਸੈਂਸਰ ਨੈੱਟਵਰਕਸ ਸੰਚਾਰ ਤਕਨੀਕ 'ਤੇ ਕੇਂਦਰਿਤ ਹੈ ਇੰਟਰਨੈਸ਼ਨਲ ਕਾਨਫਰੰਸ ਔਨ ਫਊਚਰਿਸਟਿਕਸ ਸਸਟੇਨਏਬਲ ਆਸਪੇਕਟਸ ਇਨ ਇੰਜਨੀਅਰਿੰਗ ਨਵਾਂਪਣ ਅਤੇ ਟਿਕਾਊ ਇੰਜਨੀਅਰਿੰਗ 'ਤੇ ਧਿਆਨ ਦਿੰਦੀ ਹੈ ਇੰਟਰਨੈਸ਼ਨਲ ਕਾਨਫਰਸ ਔਨ ਸਾਇੰਸ ਇੰਜੀਨੀਅਰਿੰਗ ਟੈਕਨੋਲੋਜੀ ਨਵੀਂ ਖੋਜ ਅਤੇ ਵਿਕਾਸ ਨੂੰ ਉਤਸਾਹਿਤ ਕਰਦੀ ਹੈ ਇਹ ਈਵੈਂਟਸ ਪੰਜਾਬ ਨੂੰ ਤਕਨੀਕੀ ਅਤੇ ਉਦਯੋਗਿਕ ਖੇਤਰ ਬਣਾਉਂਦੇ ਹਨ